ਸਭ ਤੋਂ ਵਧੀਆ ਕਿਤਾਬ ਮੈਨੂੰ ਅੰਮ੍ਰਿਤਾ ਪ੍ਰੀਤਮ ਦੀ ਲੱਗਦੀ ਹੈ ਜਿਸ ਨੇ ਕਿ ਆਪਦੀ ਜ਼ਿੰਦਗੀ ਵਿੱਚ ਬਹੁਤ ਵਧੀਆ ਕਿਤਾਬਾਂ ਲਿਖੀਆਂ ਹਨ ਜਿੰਨੇ ਕਿ ਜਿਸ ਵਿੱਚ ਸਾਨੂੰ ਬਹੁਤ ਸਾਰੀ ਸਿੱਖਿਆ ਮਿਲਦੀ ਹੈ ਬਹੁਤ ਸਾਰੀ ਜ਼ਿੰਦਗੀ ਦੇ ਬਾਰੇ ਮਿਲਦੀ ਸੀ ਜਿਸ ਵਿੱਚ ਸਾਨੂੰ ਉੱਨੀ ਸੌ ਚੁਰਾਸੀ ਦੇ ਸਾਰੇ ਭਾਵਿਕ ਘਟਨਾ ਜੋ ਕਿ ਅੰਮ੍ਰਿਤਸਰ ਦੇ ਅਟੈਕ ਹੋਇਆ ਸੀ ਉਹਦੇ ਬਾਰੇ ਬਿਆਨ ਕੀਤਾ ਸੀ ਕਿ ਜਿਹਦੇ ਵਿੱਚ ਮਤਲਬ ਬਹੁਤ ਸਾਰੇ ਅਟੈਕ ਕੀਤੇ ਸੀ ਬਹੁਤ ਸਾਰੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀਗਾ ਕਿਵੇਂ ਲੋਕਾਂ ਨੂੰ ਮਤਲਬ ਮਾਰਿਆ ਗਿਆ ਸੀਗਾ ਕਿਵੇਂ ਖੂਹ ਵਿੱਚ ਮਤਲਬ ਲੋਕਾਂ ਨੇ ਛਾਲਾਂ ਮਾਰ ਮਾਰ ਕੇ ਆਪਦੀਆਂ ਜਾਨਾਂ ਦਿੱਤੀਆਂ ਸੀਗੀਆਂ ਇੱਥੇ ਜਲਿਆਂਵਾਲੇ ਬਾਗ ਦੀ ਕਿਵੇਂ ਤਬਾਹੀ ਦਾ ਕਾਰਨ ਬਣਿਆ ਸੀਗਾ ਆਪਦੇ ਕੁਝ ਕਵਿਤਾ ਵਿੱਚ ਉਹਨਾਂ ਨੇ ਸਾਰੇ ਮਤਲਬ ਇਸ ਅਟੈਕ ਬਾਰੇ ਆਪਦੀ ਮਤਲਵ ਬਹੁਤ ਸਾਰੀ ਘਟਨਾ ਬਾਰੇ ਦੱਸਿਆ ਹੈ ਜਿਹਦੇ ਨਾਲ ਕੀ ਹੈ ਕਿ ਸਾਨੂੰ ਸਾਰਾ ਕੁਛ ਅੱਜ ਵੀ ਸਾਡੇ ਇਤਿਹਾਸ ਬਾਰੇ ਜਾਣਨ ਬਾਰੇ ਮਿਲਦਾ ਹੈ ਅਤੇ ਇਹਦੇ ਵਿੱਚ ਚਲੀਏ ਅੰਮ੍ਰਿਤਾ ਪ੍ਰੀਤਮ ਦੀਆਂ ਜਿਹੜੀਆਂ ਸਾਰੀਆਂ ਕਵਿਤਾ ਹਨ ਉਹਦੇ ਵਿੱਚ ਬਹੁਤ ਹੀ ਭਾਵੁਕ ਹੁੰਦੀਆਂ ਸਨ ਇਨਸਾਨੀ ਰੂਪ ਦੀਆਂ ਸਨ ਕੋਈ ਵੀ ਮਤਲਬ ਉਹਦੀ ਕਵਿਤਾ ਪੜ੍ਹ ਕੇ ਜਿਹੜਾ ਸਾਡੇ ਦਿਲ ਅਤੇ ਸਿੱਧਾ ਮਤਲਬ ਅਟੈਚ ਹੁੰਦਾ ਸੀ ਜਿਹਦੇ ਨਾਲ ਕਿ ਸਾਨੂੰ ਆਪਦੇ ਇਤਿਹਾਸ ਬਾਰੇ ਜਾਣ ਕੇ ਸਾਨੂੰ ਇਤਿਹਾਸ ਬਾਰੇ ਸਾਰਾ ਕੁਝ ਪਤਾ ਲੱਗਦਾ ਹੈ ਜਿਹਦੇ ਨਾਲ ਅਸੀਂ ਉਹਨਾਂ ਦੀਆਂ ਕਵਿਤਾ ਪੜ੍ਹ ਕੇ ਆਪਣੇ ਇਤਿਹਾਸ ਨਾਲ ਜੋੜਦੇ ਹਾਂ ਅਤੇ ਉਹਨਾਂ ਦੇ ਮਤਲਬ ਸਾਰਾ ਇਤਿਹਾਸ ਨਾਲ ਜੋੜਦੇ ਹਾਂ ਅਤੇ ਆਪਣੇ ਇਤਿਹਾਸ ਬਾਰੇ ਜਾਣਦੇ ਹਾਂ ਕਿ ਸਾਡੇ ਪਿਛਲੇ ਇਤਿਹਾਸ ਵਿੱਚ ਕੀ ਹੋਇਆ ਅਤੇ ਕਿਵੇਂ ਸਾਡੇ ਇਤਿਹਾਸ ਨੂੰ ਮਤਲਬ ਕਿ ਮਤਲਵ ਜਾਰਬ ਜ਼ੁਲਮਾਂ ਨੇ ਸਾਡੇ ਇਤਿਹਾਸ ਨਾਲ ਕਿਹੋ ਜਿਹਾ ਮਤਲਵ ਜ਼ੁਲਮ ਕੀਤਾ ਸੀ ਕਿਵੇਂ ਅਸੀਂ ਉਹਨਾਂ ਦੇ ਜ਼ੁਲਮਾਂ ਦੇ ਸ਼ਿਕਾਰ ਹੋਏ ਉਹਨਾਂ ਦੀਆਂ ਕਵਿਤਾ ਜਿਹੜੀਆਂ ਹੁੰਦੀਆਂ ਹਨ ਬਹੁਤ ਹੀ ਵਧੀਆ ਹੁੰਦੀਆਂ ਸਨ ਅਤੇ ਪੱਥਰ ਦਿਲ ਲੋਕ ਵੀ ਪੜ੍ਹ ਕੇ ਜਿਹੜੀ ਉਹਨਾਂ ਦੀ ਕਿਤਾਬਾਂ ਜਿਹੜੀਆਂ ਵਧੀਆ ਮਤਲਬ ਆਪਣੀ ਸ਼ਖਸ਼ੀਅਤ ਦੇ ਮਾਲਕ ਬਣਦੇ ਹਨ